ਸਤਿ ਸ਼੍ਰੀ ਅਕਾਲ ਜੀ ਅਤੇ ਸਰ ਮੈਂ ਨਾ ਸਰ ਨਿਊਜ਼ਪੇਪਰ ਤੋਂ ਬੋਲ ਰਿਹਾ ਸਰ ਆਪਣੇ ਸਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਆਪਣਾ ਪੰਜਾਬ 'ਚ ਸਿੱਖਿਆ ਦਾ ਸੰਚਾਰ ਕਿਸ ਤਰ੍ਹਾਂ ਚੱਲ ਰਿਹਾ ਤੁਹਾਡੇ ਜ਼ਿਲ੍ਹੇ 'ਚ ਸਰ ਜੀ ਜੀ ਬਿਲਕੁਲ ਸਰ ਪਰ ਮੈਂ ਸਰ ਨਿਊਜ਼ ਤਾਂ ਅਸੀਂ ਤੁਹਾਨੂੰ ਤਾਂ ਫੋਨ ਕੀਤਾ ਚਲੋ ਤੁਸੀਂ ਵਧੀਆ ਇੱਕ ਅਧਿਆਪਕ ਹੋ ਵਧੀਆ ਟੀਚਿੰਗ ਲਾਈਨ 'ਚ ਕਰ ਰਹੇ ਹੋ ਸਾਨੂੰ ਤੁਹਾਡਾ ਕੰਟੈਕਟ ਨੰਬਰ ਦਿੱਤਾ ਗਿਆ ਸੀ ਬਟ ਮੈਂ ਆਪਾਂ ਬਰਸਾਤੀ ਮੌਸਮ ਵਿੱਚ ਨਿਊਜ਼ ਇਕੱਠੀ ਕਰ ਰਹੇ ਹਾਂ ਕੁਛ ਸਕੂਲਾਂ 'ਚ ਪਾਣੀ ਇਕੱਠਾ ਹੋਇਆ ਇਹਨਾਂ ਨੇ ਸਮਾਰਟ ਸਕੂਲ ਦਾ ਨਾਮ ਦਿੱਤਾ ਹੋਇਆ ਉੱਥੇ ਪਾਣੀ ਕਾਫੀ ਜ਼ਿਆਦਾ ਇਕੱਠਾ ਸਕੂਲ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੈ ਕਈ ਛੱਤਾਂ ਵੀ ਚੋਅ ਰਹੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜੇ ਨਿਊਜ਼ ਆਪਾਂ ਲਗਾਏ ਲਗਾਵਾਂਗੇ ਜੀ ਜੀ ਜੀ ਮੈਂ ਸਰ ਇੱਕ ਗੱਲ ਸੁਣਨ 'ਚ ਇਹ ਵੀ ਆਈ ਹੈ ਕਿ ਆਪਾਂ ਜਦੋਂ ਸਰਵੇ ਕੀਤੇ ਆ ਕਿ ਸਕੂਲ 'ਚ ਜਿਹੜਾ ਮਿੱਡੇ ਤੁਸੀਂ ਕਿਹਾ ਜੀ ਖਾਣਾ ਖਾਣੇ ਬਾਰੇ ਗੱਲ ਕੀਤੀ ਜੇ ਅਜੇ ਸਕੂਲ ਡਿਵੈਲਪ ਹੋਇਆ ਕੁਛ ਗੱਲਾਂ ਪਿੰਡਾਂ 'ਚੋਂ ਨਿਕਲ ਕੇ ਆਈ ਹੈ ਕਿ ਸਰਪੰਚਾਂ ਨੇ ਨਾਲ ਹੈਡਮਾਸਟਰਾਂ ਨਾਲ ਰਲ ਮਿਲ ਕੇ ਪੈਸੇ ਦਾ ਇਕੱਠ ਕਰਕੇ ਖਾ ਲਏ ਇਹਨਾਂ ਨੇ ਉਹ ਤਾਂ ਬਿਲਕੁਲ ਸਹੀ ਗੱਲ ਤੁਹਾਡੀ ਜੀ ਚਲੋ ਠੀਕ ਹੈ ਸਰ ਬਹੁਤ ਵਧੀਆ ਤੁਹਾਡਾ ਲੱਗਾ ਜੀ ਸੁਝਾਅ ਸੁਣ ਕੇ ਧੰਨਵਾਦ ਜੀ ਧੰਨਵਾਦ ਜੀ ਟਾਈਮ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ